ਜੇਕਰ ਅਸੀਂ ਫ਼ਰਕ ਦੀ ਗੱਲ ਕਰੀਏ ਜੀ ਰੈਡੀਮੇਡ ਅਤੇ ਜਿਹੜੇ ਹੈਂਡਮੇਡ ਕੱਪੜੇ ਦੀ ਸਟਿਚਿੰਗ ਆ ਉਹਦੇ ਵਿੱਚ ਤਾਂ ਬਹੁਤ ਵੱਡਾ ਫ਼ਰਕ ਆ ਕਿਉਂਕਿ ਜਦੋਂ ਅਸੀਂ ਸਿਲਾਈ ਕਰਦੇ ਹਾਂ ਜੀ ਉਸ ਆਪਣੀ ਪਸੰਦ ਦਾ ਕੱਪੜਾ ਲੈ ਕੇ ਹੈ ਨਾ ਆਪਣੀ ਪਸੰਦ ਦਾ ਸਿਲਾਈ ਕਰਵਾ ਸਕਦੇ ਹਾਂ ਬਿਲਕੁਲ ਆਪਣੇ ਨਾਪ ਦਾ ਕਿਸੇ ਤਰ੍ਹਾਂ ਦੇ ਕੋਈ ਮਤਲਬ ਉਸ ਇਹਦੀ ਫਿਟਿੰਗ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਅਤੇ ਅਸੀਂ ਆਪਣੀ ਪਸੰਦ ਦੇ ਕਲਰ ਦਾ ਲੈ ਕੇ ਅਤੇ ਜਦੋਂ ਅਸੀਂ ਮਾਰਕੀਟ ਵਿੱਚ ਜਾਂਦੇ ਹਾਂ ਤਾਂ ਉਹਦੇ ਵਿੱਚ ਸਾਨੂੰ ਨਾਪ ਦੀ ਵੀ ਪ੍ਰੋਬਲਮ ਆਉਂਦੀ ਹੈ ਕਿ ਓ ਉਹ ਕੱਪੜੇ ਦੇ ਵੀ ਸਾਨੂੰ ਪ੍ਰੋਬਲਮ ਆਉਂਦੀ ਹੈ ਕਿ ਸਾਨੂੰ ਕਈ ਵਾਰ ਕਲਰ ਨਹੀਂ ਉਸ ਤਰ੍ਹਾਂ ਦਾ ਮਿਲਦਾ ਉਸ ਤਰ੍ਹਾਂ ਦੀ ਫਿਟਿੰਗ ਨਹੀਂ ਮਿਲਦੀ ਇਹ ਬਹੁਤ ਵੱਡਾ ਫ਼ਰਕ ਆ ਅਤੇ ਸਿਲਾਈ ਵਾਲੇ ਵਿੱਚ ਹੈਂਡਮੇਡ ਸਿਲਾਈ ਦੇ ਵਿੱਚ ਇਹ ਆ ਕਿ ਅਸੀਂ ਆਪਣੀ ਪਸੰਦ ਦਾ ਉਹਨੂੰ ਸਟਿੱਚ ਕਰ ਸਕਦੇ ਹਾਂ ਉਹਦੇ ਵਿੱਚ ਜਿਹੜੀ ਮਜ਼ਬੂਤੀ ਹੈ ਉਹ ਜ਼ਿਆਦਾ ਹੋਊਗੀ ਇੱਕੋ ਵਾਰੀ ਪੈਸੇ ਤਾਂ ਪੇ ਕਰਨੇ ਪੈਣਗੇ ਉਹ ਸੇਮ ਹੀ ਪੈ ਜਾਂਦਾ ਕੱਪੜਾ ਲੈ ਕੇ ਸਿਲਾਈ ਦੇਣੀ ਆ ਰੈਡੀਮੇਡ ਦੇ ਬਰਾਬਰ ਹੀ ਪੈ ਜਾਂਦਾ ਪਰ ਉਹਦੇ ਵਿੱਚ ਸਾਡੇ ਜਿਹੜਾ ਹੈਗਾ ਸਾਨੂੰ ਬੈਨੀਫਿਟ ਇਹ ਆ ਹੈਂਡਮੇਡ ਦੇ ਵਿੱਚ ਕਿ ਉਹ ਕੱਪੜਾ ਵੀ ਅਸੀਂ ਆਪਣੇ ਪਸੰਦ ਦਾ ਕਲਰ ਵੀ ਆਪਣੀ ਪਸੰਦ ਦਾ ਸਟੀਚਿੰਗ ਵੀ ਆਪਣੀ ਪਸੰਦ ਦੀ ਕਰਵਾ ਸਕਦੇ ਹਾਂ ਹੈ ਨਾ ਜਦੋਂ ਅਸੀਂ ਜੇ ਬੇਸ਼ੱਕ ਵੱਡੀ ਮਾਰਕੀਟ ਹੈਂਡ ਰੈਡੀਮੇਡ ਕੱਪੜੇ ਦੀ ਹੈਗੀ ਆ ਪਰ ਜਿਹੜੇ ਸਮਝਦਾਰ ਲੋਕ ਨੇ ਗੇ ਹੈ ਨਾ ਜਿੰਨ੍ਹਾ ਦੀ ਪਹੁੰਚ ਹੈਗੀ ਆ ਸਿਲਾਈ ਕਰਵਾਉਣ ਤੱਕ ਉਹ ਜਿਹੜੇ ਹੈਂਡਮੇਡ ਨੂੰ ਹੀ ਜਿਹੜਾ ਉਹ ਪ੍ਰੈਫਰ ਕਰਦੇ ਨੇ ਜ਼ਿਆਦਾ ਪਸੰਦ ਕਰਦੇ ਨੇ ਲੋਕ ਹੈਂਡਮੇਡ ਨੂੰ ਹੀ ਇਵਨ ਕਿ ਰੈਡੀਮੇਟ ਦੀ ਬਜਾਏ